ਪਟਿਆਲੇ ਜ਼ਿਲ੍ਹੇ ਵਿੱਚ ਸਿੱਖਿਆ ਰੁਜ਼ਗਾਰ ਅਤੇ ਲੀਡਰਸ਼ਿਪ ਦੇ ਰੂਪ ਵਿੱਚ ਨੌਜਵਾਨਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਵੇਖਣ 'ਚ ਆਉਂਦੀਆਂ ਹਨ ਖਾਸ ਕਰਕੇ ਗਰੀਬੀ ਅਤੇ ਕੁਆਲਿਟੀ ਐਜੂਕੇਸ਼ਨ ਨਾ ਹੋਣ ਕਾਰਨ ਇਹ ਸਮੱਸਿਆਵਾਂ ਬਹੁਤ ਵੱਡੀਆਂ ਹਨ ਪੇਰੈਂਟਸ ਸਿੰਗਲ ਪੇਰੈਂਟਸ ਹਨ ਜੋ ਕਿ ਆਪਣੇ ਬੱਚਿਆਂ ਨੂੰ ਬਹੁਤਾ ਐਕਸਪੋਜ਼ਰ ਨਹੀਂ ਦੇ ਪਾਉਂਦੇ ਅਤੇ ਨਾ ਹੀ ਉਹ ਉਹਨਾਂ ਨੂੰ ਕਿਤੇ ਬਾਹਰ ਖੁੱਲ੍ਹੇ ਆਮ ਪੜ੍ਹਨ ਲਈ ਭੇਜਦੇ ਹਨ ਜਿਸ ਨਾਲ ਬੱਚੇ ਦੀ ਵਿਕਾਸ ਰੁਕਦਾ ਰਹਿੰਦਾ ਹੈ ਗਰੀਬੀ ਨੇ ਇਸ ਨੂੰ ਹੋਰ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਰੂਰਲ ਏਰੀਏ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੇਰੈਂਟਸ ਕੋਲ ਇੱਕ ਤਰੀਕੇ ਨਾਲ ਤਿੰਨ ਟਾਇਮ ਦੀ ਰੋਟੀ ਦੇ ਚੱਕਰ ਦੇ ਵਿੱਚ ਫਸੇ ਹੋਏ ਹਨ ਜਿਸ ਕਾਰਨ ਉਹ ਅਪਣੇ ਬੱਚਿਆਂ ਦੀ ਪੜ੍ਹਾਈ ਉੱਪਰ ਉਸ ਤਰੀਕੇ ਦਾ ਖਰਚਾ ਨਹੀਂ ਕਰ ਸਕਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਆਉਂਦੇ ਹਨ ਜਿੱਥੇ ਸਹੂਲਤਾਂ ਦੀ ਪਹਿਲਾਂ ਹੀ ਬਹੁਤ ਘਾਟ ਹੁੰਦੀ ਹੈ ਜਿਸ ਨਾਲ ਉਹਨਾਂ ਦਾ ਆਈਕਿਊ ਲੈਵਲ ਉਸ ਤਰੀਕੇ ਨਾਲ ਉੱਚਾ ਨਹੀਂ ਹੋ ਪਾਉਂਦਾ ਜਿਸ ਨਾਲ ਉਹਨਾਂ ਨੂੰ ਬਹੁਤ ਵੱਡੀ ਸਮੱਸਿਆ ਅੱਗੇ ਹਾਇਅਰ ਸਟੱਡੀਜ਼ ਦੇ ਵਿੱਚ ਆਉਂਦੀ ਹੈ ਹਾਇਰ ਸਟੱਡੀਜ਼ ਦੇ ਵਿੱਚ ਵੀ ਜਦੋਂ ਬੱਚੇ ਪਹੁੰਚਦੇ ਹਨ ਤਾਂ ਪ੍ਰਾਈਵੇਟਾਈਜੇਸ਼ਨ ਦੇ ਦੌਰ ਹੋਣ ਕਾਰਨ ਕੁਆਲਿਟੀ ਐਜੂਕੇਸ਼ਨ ਕਟਹਿਰੇ ਦੇ ਵਿੱਚ ਖੜ੍ਹ ਗਈ ਹੈ ਵੱਧ ਤੋਂ ਵੱਧ ਅਡਮਿਸ਼ਨਸ ਦੀ ਕੋਲਿਜਿਸ ਨੂੰ ਸਕੂਲਾਂ ਨੂੰ ਲੋੜ ਹੁੰਦੀ ਹੈ ਜਿਸ ਕਾਰਨ ਉਹ ਮਾਪਿਆਂ ਨੂੰ ਖੁਸ਼ ਕਰਨ ਦੇ ਲਈ ਵੱਧ ਤੋਂ ਵੱਧ ਨੰਬਰ ਦੇ ਕੇ ਤੋਰਦੇ ਹਨ ਪਰੰਤੂ ਜਦੋਂ ਬੱਚਾ ਹਾਇਅਰ ਸਟੱਡੀਜ਼ ਨੂੰ ਪਾਸ ਕਰਕੇ ਬਾਹਰ ਕੋਈ ਕੰਮ ਲੱਭਣ ਲਈ ਜਾਂ ਨੌਕਰੀ ਲੱਭਣ ਲਈ ਜਾਂਦਾ ਹੈ ਤਾਂ ਉੱਥੇ ਖਾਸ ਕਰਕੇ ਸਕਿੱਲ ਉੱਪਰ ਧਿਆਨ ਦਿੱਤਾ ਜਾਂਦਾ ਹੈ ਪਰੰਤੂ ਕੁਆਲਿਟੀ ਐਜੁਕੇਸ਼ਨ ਨਾ ਹੋਣ ਕਰਕੇ ਉਹਨਾਂ ਕੋਲ ਉਵੇਂ ਦੀ ਸਕਿੱਲ ਨਹੀਂ ਹੁੰਦੀ ਜਿਸ ਨਾਲ ਬੱਚੇ ਅੱਗੇ ਨਹੀਂ ਵੱਧ ਪਾਉਂਦੇ ਅਤੇ ਉਹਨਾਂ ਨੂੰ ਇਹਨਾਂ ਸਾਰੇ ਖਿੱਤਿਆਂ ਦੇ ਵਿੱਚ ਸਿੱਖਿਆ ਰੁਜ਼ਗਾਰ ਅਤੇ ਲੀਡਰਸ਼ਿਪ ਦੇ ਵਿੱਚ ਦਿੱਕਤ ਆਉਂਦੀ ਹੈ ਪਰੰਤੂ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਅੱਜ ਦੇ ਸਮੇਂ ਵਿੱਚ ਪਟਿਆਲੇ ਜ਼ਿਲ੍ਹੇ ਵਿੱਚ ਕੁਝ ਵੀ ਕੰਮ ਕਰਨ ਯੋਗ ਚੀਜ਼ਾਂ ਨਹੀਂ ਹਨ ਬਹੁਤ ਕੁਝ ਇੱਥੇ ਮੌਕੇ ਵੀ ਵੇਖੇ ਜਾ ਸਕਦੇ ਹਨ ਜਿਵੇਂ ਖੇਤੀਬਾੜੀ ਅਤੇ ਹੋਰ ਛੋਟੀਆਂ ਇੰਡਸਟਰੀਆਂ ਦੇ ਵਿੱਚ ਕੰਮ ਜੋ ਹਨ ਉਹ ਵਧੇ ਹਨ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੀ ਇਸ ਪਾਸੇ ਵੱਲ ਲਗਾਤਾਰ ਖਾਸ ਧਿਆਨ ਦੇ ਰਹੀ ਹੈ ਲਘੂ ਉਦਯੋਗਾਂ ਵਿੱਚ ਮੋਲਾਂ ਦੇ ਵਿੱਚ ਛੋਟੀਆਂ ਨੌਕਰੀਆਂ ਨੂੰ ਤਰਜੀਹ ਬੱਚੇ ਦੇ ਰਹੇ ਹਨ ਅਤੇ ਪਾਰਟ ਟਾਈਮ ਨੌਕਰੀਆਂ ਦਾ ਵੀ ਰੁਝਾਨ ਵੱਧ ਰਿਹਾ ਹੈ